ਪੰਜ ਨਵੰਬਰ ਉੱਨੀ ਸੌ ਪੱਚਾਸੀ ਛੇ ਜੂਨ ਦੋ ਹਜ਼ਾਰ ਛੇ ਸੱਤ ਜੁਲਾਈ ਦੋ ਹਜ਼ਾਰ ਸੱਤ ਅੱਠ ਜੂਨ ਦੋ ਹਜ਼ਾਰ ਚਾਰ ਪੰਜ ਫਰਵਰੀ ਦੋ ਹਜ਼ਾਰ ਇੱਕ